ਗੁਡ ਮੋਰਨਿੰਗ ਜੀ ਹਾਂਜੀ ਹਾਂਜੀ ਹਾਂਜੀ ਨਮਸਕਾਰ ਜੀ ਹਾਂਜੀ

ਹਾਂਜੀ ਅੱਛਾ ਅੱਛਾ ਪੰਜਾਬ 'ਤੇ ਰਿਗਾਰਡਿੰਗ ਪੁੱਛਣਾ ਚਾਹੁੰਦੇ ਹੋ ਕਿ ਐਕਚੁਲੀ ਮੈਮ ਪੰਜਾਬ ਵੈਸੇ ਅੱਗੇ ਤਾਂ ਬਹੁਤ ਵੱਧ ਚੁੱਕਿਆ ਪਰ ਹਲੇ ਵੀ ਇਥੇ ਨਾ ਅਨੇਕ ਵਿਸ਼ਵਾਸ ਬਹੁਤ ਲੋਕਾਂ ਪਿੰਡਾਂ 'ਚ ਜਾਂਦੇ ਆ ਤਾਂ ਬਹੁਤ ਹੀ ਅੰਧ ਵਿਸ਼ਵਾਸ ਵੇਖਣਗੇ ਜਿਵੇਂ ਦੁੱਧ ਡੁੱਲ ਗਿਆ ਦੁੱਧ ਉਧਰ ਜਾਏ ਤਾਂ ਉਹ ਘਰ ਦੇ ਵੱਡੇ ਬੜਾ ਹੀ ਕਹਿੰਦੇ ਨੇ ਵੀ ਬੜਾ ਵੱਡਾ ਅਪਸ਼ਗਨ ਹੋ ਗਿਆ ਕਹਿੰਦੇ ਵੀ ਘਰ ਦਾ ਕੋਈ ਨੁਕਸਾਨ ਹੋਏਗਾ ਕੁਝ ਕਿਸੇ ਨਾਲ ਕੋਈ ਗਲਤ ਘਟਨਾ ਵਾਪਰ ਜਾਏਗਾ ਇਹ ਹਾਂਜੀ ਹਾਂਜੀ ਵੀ ਮੰਨ ਲੋ ਬਿੱਲੀ ਰਸਤਾ ਕੱਟ ਜਾਏ ਉਹ ਵੀ ਵਹਿਮ ਕਰ ਹਾਂਜੀ ਹਾਂਜੀ ਬਿੱਲੀ ਰਸਤਾ ਕੱਟ ਗਈ ਤੇ ਬਸ ਵਾਪਿਸ ਆਜੋ ਜਾਂ ਜਾਓ ਨਾ ਕਿਤੇ ਕਿਉਂਕਿ ਜੇ ਮੰਨ ਲਓ ਜੇ ਆਪਾਂ ਨਾ ਮੰਨੀਏ ਵੱਡੇ ਤੇ ਗੱਲ ਤੋਂ ਕਹਿੰਦੇ ਨੇ ਵੀ ਕੁਝ ਨਾ ਕੁਝ ਪੱਕਾ ਹੋ ਜੇ ਗਾ ਤੂੰ ਨਹੀਂ ਜਾਣਾ ਬੜਾ ਵਹਿਮ ਕਰਦੇ ਨੇ ਵੀ ਰਾਤੀ ਕੁੱਤੇ ਰੋਣ ਲੱਗ ਜਾਣ ਤੇ ਉਹ ਵੀ ਬੜਾ ਵਹਿਮ ਕੁੱਤੇ ਕਿਉਂ ਰੋਈ ਜਾਂਦੇ ਨੇ ਜੇ ਬਿੱਲੀ ਜੇ ਬਿੱਲੀ ਰੋਏ ਤਾਂ ਵੀ ਬੜਾ ਵਹਿਮ ਐ ਵੀ ਹਾਂ ਇੰਜ ਨਹੀਂ ਹੋਣਾ ਚਾਹੀਦਾ ਬਿੱਲੀ ਨਹੀਂ ਨਹੀਂ ਪਰ ਮੈਡਮ ਇਹ ਬੜੇ ਅਪਸ਼ਗਨ ਮੰਨੇ ਜਾਂਦੇ ਨੇ ਸਾਰੇ ਨਾ ਮਤਲਬ ਕਹਿੰਦੇ ਨੇ ਵੀ ਇਹ ਤਾਂ ਬਹੁਤ ਵੱਡਾ ਅਪਸ਼ਗਨ ਹੋ ਕੇ ਹੀ ਰਹਿਣਾ ਇਸ ਲਈ ਪਹਿਲਾ ਜਿਵੇਂ ਝਾੜੂ ਏ ਕਰਦਾ ਕੋਈ ਬਾਹਰ ਚੱਲਿਆ ਪਿੱਛੋਂ ਆਵਾਜ਼ ਨਹੀਂ ਮਾਰਨੀ ਮਾਰਨ ਲਈ ਤਾਂ ਅਪਸ਼ਗਨ ਮਨੋ ਵੀ ਇਨੀ ਕੋਈ ਕੰਮ ਮੰਨ ਲਓ ਕੋਈ ਕੰਮ ਚੱਲਿਆ ਚੰਗੇ ਤੇ ਉਹਦਾ ਕੰਮ ਹੀ ਨਹੀਂ ਆਉਣਾ ਇਹ ਵੀ ਅਪਸ਼ਗਨ ਮੰਨਿਆ ਜਾਂਦਾ ਹਾਂ ਝਾੜੂ ਦੇ ਉੱਪਰ ਨੀ ਟੱਪਣਾ ਝਾੜੂ ਝਾੜੂ ਜੇ ਕਰਦਾ ਕੋਈ ਚੱਲਿਆ ਤੇ ਝਾੜੂ ਨਹੀਂ ਮਾਰਨੀ ਉਸ ਵੇਲੇ ਇਹ ਅੰਧ ਵਿਸ਼ਵਾਸ ਪੜੇ ਨੇ ਹੁਣ ਵੀ ਵਾਰ ਕੱਪੜੇ ਨਹੀਂ ਧੋਨੇ ਇਹ ਵੀ ਕੀਤਾ ਬਹੁਤ ਜਿਆਦਾ ਹਾਂ ਵੀ ਨਹੀਂ ਬੀ ਝਾੜੂ ਨਹੀਂ ਮਾਰਨੀ ਕੋਈ ਚੱਲਿਆ ਕੋਈ ਅਪਸ਼ਗਨ ਨੇ ਪਿੱਛੋਂ ਆਵਾਜ਼ ਨਹੀਂ ਮਾਰਨੀ ਪੜੀਏ ਹੀ ਚੀਜ਼ਾਂ ਉਹਨੇ ਫੜੀਆਂ ਹੀ ਵੀ ਐਵੇਂ ਨਹੀਂ ਕਰਨਾ ਕਿਸੇ ਕਿਸੇ ਰਾਤ ਨੂੰ ਹੁਣ ਅੱਜਕੱਲ ਤਾਂ ਇਹ ਵੀ ਵਹਿਮ ਕਰਨ ਲੱਗ ਗਏ ਪਤਾ ਨਹੀਂ ਆ ਫੇਸਬੁਕ ਤੇ ਯੂਟੀਊਬ ਤੇ ਨਾਂ ਦਾ ਵੀ ਦੁੱਧ ਕਿਸੇ ਘਰੋਂ ਰਾਤ ਨੂੰ ਚਿੱਟੀ ਚੀਜ਼ ਨਹੀਂ ਮੰਗਣੀ ਨਮਕ ਲੈਣ ਨਹੀਂ ਜਾਣਾ ਕਿਸੇ ਕੋਲੋਂ ਮੰਨ ਲਓ ਖਤਮ ਹੋ ਗਿਆ ਜਾਂ ਖੱਟਾ ਲੈਣਾ ਦਹੀਂ ਜਮਾਨੀਏ ਤੇ ਉਹ ਨਹੀਂ ਹਾਂ ਨਾ ਨਾ ਬਹੁਤ

ਹਾਂ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਜਰੂਰ ਮੈਮ ' ਚ ਕੋਈ ਗੱਲ ਨਹੀਂ ਜਦੋਂ ਵੀ ਤੁਹਾਨੂੰ ਲੋੜ ਲੱਗੇ ਫੋਨ ਕਰ ਦੇਣ

ਕੋਈ ਗੱਲ ਨਹੀਂ ਹਾਂਜੀ ਠੀਕ ਹੈ

ਠੀਕ ਹੈ ਠੀਕ ਹੈ ਵੈਲਕਮ ਜੀ ਵੈਲਕਮ